ਯੋਗਾ ਇੱਕ ਇਹੋ ਜਿਹਾ ਰਾਮਬਾਣ ਇਲਾਜ ਹੈ ਜਿਹਦੇ ਕਰਕੇ ਸਾਡੇ ਸਰੀਰ ਨੂੰ ਇੱਕ ਨਵੀਂ ਊਰਜਾ ਮਿਲਦੀ ਹੈ ਮੈਂ ਡੇਢ ਘੰਟੇ ਦਾ ਯੋਗੇ ਦਾ ਅਭਿਆਸ ਕਰਦੀ ਹਾਂ ਜਿਹਦੇ ਵਿੱਚ ਮੈਂ ਸ਼ੀਸ਼ ਆਸਣ ਓਮ ਬਿਲੋਮ ਕਪਾਲਭਾਰਤੀ ਅਤੇ ਬਟਰਫਲਾਈ ਆਸਣ ਜ਼ਰੂਰ ਕਰਦੀ ਹਾਂ ਜਿਹਦੇ ਕਰਕੇ ਸਾਡੇ ਸਰੀਰ ਨੂੰ ਖੂਨ ਦੀ ਮਾਤਰਾ ਵੱਧਦੀ ਹੈ ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਹਰ ਇੱਕ ਤਰੀਕੇ ਦੀ ਊਰਜਾ ਵਧੇਗੀ ਅਤੇ ਸਾਡੇ ਸਰੀਰ ਦੇ ਵਿੱਚ ਖੂਨ ਦੀ ਮਾਤਰਾ ਵੀ ਵਧੇਗੀ ਸ਼ ਸਵੇਰ ਦੇ ਪੰਜ ਵਜੇ ਤੋਂ ਲੈ ਕੇ ਛੇ ਵਜੇ ਸਾਢੇ ਛੇ ਵਜੇ ਤੱਕ ਦਾ ਪੂਰਾ ਇੱਕ ਡੇਢ ਘੰਟੇ ਦਾ ਸੈਸ਼ਨ ਹੁੰਦਾ ਹੈ ਜਿਹਦੇ ਕਰਕੇ ਕਿ ਸਾਡੇ ਸਰੀਰ ਨੂੰ ਪੰਦਰਾਂ ਤੋਂ ਵੀਹ ਵੀਹ ਮਿੰਟ ਦੇ ਰਾਮਬਾਣ ਆਸਣ ਕਰਨੇ ਪੈਂਦੇ ਹਨ ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਕੋਈ ਵੀ ਰੋਗ ਦੀ ਕੋਈ ਵੀ ਜਗ੍ਹਾ ਨਹੀਂ ਰਹਿੰਦੀ ਇਸ ਕਰਕੇ ਸਾਨੂੰ ਇਸ ਅਸ ਇਹਨਾਂ ਆਸਣਾਂ ਨੂੰ ਕਰਨਾ ਚਾਹੀਦਾ ਹੈ ਅਤੇ ਸਾਡੇ ਸਰੀਰ ਦੇ ਸਾਰੇ ਰੋਗ ਮਿਟਾਉਣੇ ਚਾਹੀਦੇ ਹਨ ਇਹ ਮੈਂ ਹਮੇਸ਼ਾ ਆਪਣੇ ਟੈਰਿਸ ਜਾਂ ਕੋਠੇ 'ਤੇ ਕਰਦੀ ਹਾਂ ਅਤੇ ਜਾਂ ਫਿਰ ਵਰਾਂਡੇ ਦੇ ਵਿੱਚ ਕਰਦੀ ਹਾਂ ਯੋਗੇ ਦੀ ਅਭਿਆਸ